ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਨਿਸ਼ਾ ਬੋਲਦੇ ਜੀ ਮੈਮ ਮੈਂ ਨਾ ਹਿਮਾਚਲ ਤੋਂ ਨਵਾਂ ਆਇਆ ਪੰਜਾਬ ਵਿੱਚ ਰਹਿਣ ਨਵਾਂ ਸ਼ਹਿਰ ਤਾਂ ਮੈਂ ਨਾ ਇੱਥੇ ਇਹਦੇ ਬਾਰੇ ਜਾਣਨਾ ਚਾਹੁੰਦਾ ਦੋ ਤਿੰਨ ਸ਼ਹਿਰਾਂ ਬਾਰੇ ਇੱਥੇ ਕਿਹੜੀ ਕਿਹੜੀ ਜਗ੍ਹਾ ਹੁੰਦੀ ਹੈ ਉਹਨਾਂ ਵਿਚ ਕਿਆ ਕਿਆ ਚੀਜ਼ ਘੁੰਮਣ ਵਾਸਤੇ ਬਾਕੀ ਮੈਂ ਨ ਨਵਾਂਸ਼ਹਿਰ ਰੁਕਿਆ ਜੀ ਹਾਂਜੀ ਅੱਛਾ ਅੱਛਾ ਜੀ ਹਾਂਜੀ ਅੱਛਾ ਜੀ ਰੌਕ ਗਾਰਡਨ ਹੈਗਾ ਚੰਡੀਗੜ੍ਹ ਠੀਕ ਚੰਡੀਗੜ੍ਹ ਵਿੱਚ ਹੈਗਾ ਰੌਕ ਗਾਰਡਨ ਅੱਛਾ ਜੀ ਸੁਖਨਾ ਲੇਕ ਅੱ ਹਾਂਜੀ ਉੱਥੇ ਕਿਆ ਕਿਆ ਹੈ ਲੁਧਿਆਣੇ ਵਿੱਚ ਕਿਆ ਕਿਆ ਹੈਗਾ ਘੁੰਮਣ ਵਾਸਤੇ ਦੇਖਣ ਨੂੰ ਅੱਛਾ ਜੀ ਅਤੇ ਅਤੇ ਰੋਪੜ ਸ਼ਹਿਰ ਵੀ ਮੈਂ ਸੁਣਿਆ ਬਹੁਤ ਮਸ਼ਹੂਰ ਹੈ ਇੱਥੇ ਕਿਆ ਕਿਆ ਹੈਗਾ ਅੱਛਾ ਜੀ ਹਾਂਜੀ ਨਹੀਂ ਮੈਮ ਕਾਰ ਦੇ ਥਰੂ ਹਾਂਜੀ ਹਾਂਜੀ ਚਲਦਾ ਹੈ

ਠੀਕ ਹੈ ਜੀ ਜਦੋਂ ਜਾਣਾ ਹੋਉਂਗਾ ਦਸ ਦੂੰਗਾ ਓਕੇ ਨੋ ਮੈਮ ਥੈਂਕ ਯੂ